ਹਾਂਜੀ ਮੈਂ ਗੂਗਲ ਮੀਟ 'ਤੇ ਔਨਲਾਈਨ ਕਲਾਸਿਸ ਲਗਾਈਆਂ ਸੀ ਜਦੋਂ ਕੋਵਿਡ ਸੀ ਉਦੋਂ ਸਾਡੀਆਂ ਕਲਾਸਿਸ ਗੂਗਲ ਮੀਟ 'ਤੇ ਜਾਂ ਫਿਰ ਜੂਮ 'ਤੇ ਹੀ ਲੱਗਦੀਆਂ ਸੀ ਅਤੇ ਅਸੀਂ ਏ ਇਹ ਕਲਾਸਿਸ ਆਪਣੇ ਟੀ ਟੀਚਰਸ ਨਾਲ ਅਤੇ ਆਪਣੇ ਫਰੈਂਡਸ ਨਾਲ ਔਨਲਾਈਨ ਲਗਾਉਂਦੇ ਸੀ ਵੀਡੀਓ ਕੋਨਫਰੈਸਿੰਗ ਵੀ ਹੁੰਦੀ ਸੀ ਅਤੇ ਇਸ ਇਸ ਉਹਦਾ ਮੀਟਿੰਗ ਦਾ ਤਜ਼ਰਬਾ ਇਹ ਸੀ ਕਿ ਪਹਿਲਾਂ ਤਾਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਕਿਉਂਕਿ ਨੈਟਵਰਕ ਇਸ਼ੂ ਸਭ ਤੋਂ ਜ਼ਿਆਦਾ ਹੁੰਦਾ ਸੀ ਅਤੇ ਬਾਕੀ ਚਲੋ ਹੁਣ ਕੋਵਿਡ ਚੱਲ ਰਿਹਾ ਸੀ ਫਿਜੀਕਲੀ ਕਲਾਸਿਸ ਨਹੀਂ ਲਗਾ ਸਕਦੇ ਸੀ ਇਸ ਕਰਕੇ ਸਾਡਾ ਨੁਕਸਾਨ ਨਾ ਹੋਵੇ ਇਹ ਸਰਕਾਰ ਨੇ ਸਾਨੂੰ ਫੈਸਿਲਟੀ ਅਵੇਲ ਕਰਵਾਈ ਸੀ ਤਾਂ ਜੋ ਅਸੀਂ ਆਪਣਾ ਜੋ ਸਿਲੇਬਸ ਹੈ ਆਪਣੀਆਂ ਕਲਾਸਿਸ ਹੈ ਉਹਨਾਂ ਨੂੰ ਕੰਟੀਨਿਊ ਕਰ ਸਕੀਏ ਅਤੇ ਆਪਣੇ ਸਮੈਸਟਰਸ ਨੂੰ ਨਾ ਰੋਕੀਏ ਇਸ ਕਰਕੇ ਵਧੀਆ ਸੀ ਤਜ਼ਰਬਾ ਕਿਉਂਕਿ ਸਾਡੀਆਂ ਕਲਾਸਿਸ ਨਹੀਂ ਰੁਕੀਆਂ ਸਾਨੂੰ ਪੜ੍ਹਨ ਦ ਪੜ੍ਹਨ ਦਾ ਮੌਕਾ ਮਿਲਿਆ ਇੱਕ ਨਿਊ ਐਕਸਪੀਰੀਅਸ ਕਰਨ ਦਾ ਮੌਕਾ ਮਿਲਿਆ ਅਤੇ ਬਾਕੀ ਨਾ ਪਸੰਦ ਇਹ ਹੈ ਕਿ ਸਾਡਾ ਨੈਟਵਰਕ ਇਸ਼ੂ ਆ ਜਾਂਦਾ ਸੀ ਅਤੇ ਬਾਕੀ ਟੀਚਰਸ ਸਾਡੀਆਂ ਕਲਾਸਿਸ ਕਿਸੇ ਵੀ ਟਾਈਮ ਲਗਾ ਦਿੰਦੇ ਸੀ ਇਸ ਤਰ੍ਹਾਂ ਫਿਰ ਬਾਕੀ ਹੋਰ ਪਿੱਛੇ ਕਿੰਨੀ ਡਿਸਟਰਬੈਂਸ ਹੁੰਦੀ ਸੀ ਜਦੋਂ ਟੀਚਰਸ ਨੂੰ ਵੀ ਅਤੇ ਸਟੂਡੈਂਟਸ ਨੂੰ ਵੀ ਜਦੋਂ ਔਨਲਾਈਨ ਕਲਾਸ ਲੱਗਦੀ ਸੀ ਪਿੱਛੇ ਕਿੰਨੀ ਡਿਸਟਰਬੈਂਸ ਹੁੰਦੀ ਸੀ ਵੋਇਸ ਦੀ ਜਦੋਂ ਅਨਮਿਊਟ ਕਰਕੇ ਅਸੀਂ ਆਪਣੀ ਗੱਲਾਂ ਨੂੰ ਡਿਸਕਸ ਕਰਦੇ ਸੀ ਟੀਚਰਸ ਨਾਲ ਅਤੇ ਟੀਚਰ ਸਾਡੇ ਨਾਲ ਤਾਂ ਓਵੀਅਸ ਨੋਇਸ ਤਾਂ ਹੋਣੀ ਓ ਹੋਣੀ ਹੈ ਅਤੇ ਇਹਦੇ ਨਾਲ ਫਿਰ ਸਾਨੂੰ ਇਹ ਸ ਸਾਨੂੰ ਗੱਲ ਨਹੀਂ ਪਸੰਦ ਆਈ ਪਰ ਪਸੰਦ ਹੈ ਕਿਉਂਕਿ ਸਾਡਾ ਸਮੈਸਟਰ ਨਹੀਂ ਰੁਕਿਆ ਹੈਗਾ ਬਸ ਐਨੀ ਕੁ ਗੱਲ ਹੈ